ਮੈਨੂੰ ਸਰਦੀਆਂ ਦੇ ਮੌਸਮ ਵਿੱਚ ਘੁੰਮਣਾ ਬਹੁਤ ਪਸੰਦ ਹੈ ਇਸ ਲਈ ਕਿਉਂਕਿ ਮੈ ਮੈਨੂੰ ਘੁੰਮਣਾ ਇਸ ਲਈ ਬਹੁਤ ਪਸੰਦ ਐ ਮੈਨੂੰ ਸਰਦੀਆਂ ਦੇ ਮੌਸਮ ਵਿੱਚ ਘੁੰਮਣਾ ਬਹੁਤ ਪਸੰਦ ਹੈ ਕਿਉਂਕਿ ਮੈਂ ਉਸ ਦਿਨ ਛੁੱਟੀਆਂ ਦੇ ਵਿੱਚ ਮੈਂ ਆਪ ਆਪਾਂ ਮਨਾਲੀ ਜਾ ਸਕਦੇ ਹਾਂ ਤੇ ਆਪਾਂ ਉੱਥੇ ਬਰਫ਼ ਦੇ ਨਜ਼ਾਰੇ ਲੈ ਸਕਦੇ ਹਾਂ ਮੈਂ ਇੱਕ ਦੇ ਇੱਕ ਵਾਰ ਆਪਣੇ ਫੈਮਿਲੀ ਦੇ ਨਾਲ ਘੁੰਮਣ ਮਨਾਲੀ ਘੁੰਮਣ ਗਿਆ ਸੀ ਉਦੋਂ ਬਹੁਤ ਸਰਦੀ ਸੀ ਅਤੇ ਆਪਾਂ ਉੱਥੇ ਜਾ ਕੇ ਬਹੁਤ ਨਜ਼ਾਰੇ ਕੀਤੇ ਅਤੇ ਤਾਂ ਜੋ ਮੈਨੂੰ ਇਹ ਪਸੰਦ ਨਜ਼ਾਰੇ ਕੀਤੇ ਅਤੇ ਅਸੀਂ ਉੱਥੇ ਜਾ ਕੇ ਬਹੁਤ ਖੇਡੇ ਕੂਦੇ ਆਪਣੇ ਘਰਦਿਆਂ ਨਾਲ ਬਹੁਤ ਫੋਟੋਆਂ ਖਿੱਚੀਆਂ ਅਤੇ ਫਿਰ ਉਸ ਤੋਂ ਬਾਅਦ ਆਪਾਂ ਚੰਗੇ ਚੰਗੇ ਹੋਟਲਾਂ ਵਿੱਚ ਵਧੀਆ ਵਧੀਆ ਹੋਟਲਾਂ ਵਿੱਚ ਆਪਾਂ ਰੁਕੇ ਅਤੇ ਉੱਥੇ ਆਪਾਂ ਵਧੀਆ ਵਧੀਆ ਖਾਣਾ ਖਾਦਾ ਅਤੇ ਆਪਾਂ ਉੱਥੇ ਫਿਰ ਖਾਣੇ ਖਾਣ ਤੋਂ ਬਾਅਦ ਆਪਾਂ ਸਵੇਰੇ ਉੱਠ ਕੇ ਆਪਾਂ ਉੱਥੇ ਦੇਖਿਆ ਕਿ ਸਨਸੈਟ ਸ ਮੈਂ ਉੱਥੇ ਵੇਖਿਆ ਸਨਸੈੱਟ ਕਿੱਡਾ ਵਧੀਆ ਮੈਂ ਉੱਥੇ ਸਨਸੈੱਟ ਦੇ ਬਹੁਤ ਨਜ਼ਾਰੇ ਲਿੱਤੇ ਅਤੇ ਸਨਸੈੱਟ ਬਹੁਤ ਵਧੀਆ ਵੇਖਿਆ ਅਤੇ ਮੈਨੂੰ ਇਸ ਲਈ ਵੇਖਣ ਨਜ਼ਾਰਾ ਆਇਆ ਅਤੇ ਫਿਰ ਉਸ ਤੋਂ ਬਾਅਦ ਆਪਾਂ ਆਪਣੇ ਘਰਦਿਆਂ ਦੇ ਨਾਲ ਉੱਥੋਂ ਬਾਅਦ ਹੋਟਲ ਤੋਂ ਰਹਿਣ ਤੋਂ ਬਾਅਦ ਆਪਾਂ ਫਿਰ ਹੋਰ ਕਿਤੇ ਘੁੰਮਣ ਚੱਲ ਗਏ ਫਿਰ ਆਪਾਂ ਉੱਥੇ ਚੰਗੇ ਚੰਗੇ ਜੰਗਲਾਂ ਵਿੱਚ ਘੁੰਮੇ ਪਹਾੜਾਂ ਵਿੱਚ ਘੁੰਮੇ ਸਨ ਅਤੇ ਆਪਾਂ ਉੱਥੇ ਜਾ ਕੇ ਦੇਖਿਆ ਕਿ ਕਿਵੇਂ ਲੋਕ ਰਹਿ ਰਹੇ ਹਨ ਅਤੇ ਕਿਵੇਂ ਦਾ ਰਹਿਣ ਦਾ ਢੰਗ ਸੰਗ ਹੈ ਸੰਗ ਅਤੇ ਫਿਰ ਆਪਾਂ ਉੱਥੇ ਜੰਗਲਾਂ ਵਿੱਚ ਘੁੰਮੇ ਪਹਾੜਾਂ ਵਿੱਚ ਘੁੰਮੇ ਆਪਾਂ ਉੱਥੇ ਬਹੁਤ ਸਾਰੇ ਜਾਨਵਰ ਵੀ ਦੇਖੇ ਅਤੇ ਹੋਰ ਇਸ ਲਈ ਮੈਨੂੰ ਸਰਦੀਆਂ ਦੇ ਵਿੱਚ ਘੁੰਮਣਾ ਬਹੁਤ ਪਸੰਦ ਹੈ ਤਾਂ ਜੋ ਮੈਂ ਆਪਣਾ ਮਨ ਅਤੇ ਆਪਣਾ ਦਿਮਾਗ ਫਰੈਸ਼ ਕਰ ਸਕਾਂ ਅਤੇ ਹੋਰ ਬਸ ਥੈਂਕ ਯੂ